ਪੰਜਾਬ ਨੂੰ ਦਰ ਦਰਪੇਸ ਮੁਦਿਆਂ ਦੀ ਚੁਣੌਤੀਆਂ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਦੁਆਰਾ ਬਹੁਤ ਸਾਰੀਆਂ ਨੀਤੀਆਂ ਲਾਗੂ ਕੀਤੀਆਂ ਗਈਆਂ ਹਨ ਜਿਵੇਂ ਕਿ ਜਿਵੇਂ ਕਿ ਕੋਈ ਵੀ ਵਿਅਕਤੀ ਆਪਣਾ ਬਿਜਨਸ ਜਾਂ ਕੋਈ ਕੰਮ ਕਰਨਾ ਚਾਹੁੰਦਾ ਹੈ ਅਤੇ ਉਹ ਸਰਕਾਰ ਦੀ ਸਹਾਇਤਾ ਸਰਕਾਰ ਦੀ ਸਹਾਇਤਾ ਨਾਲ ਕਰਨਾ ਚਾਹੁੰਦਾ ਹੈ ਅਤੇ ਸਰਕਾਰ ਉਹਨਾਂ ਦੀ ਮਦਦ ਕਰਦੀ ਹੈ ਜਿਵੇਂ ਕਿ ਉਹਨਾਂ ਨੂੰ ਉਹਨਾਂ ਦੇ ਕਾਰੋਬਾਰ ਲਈ ਕੁਝ ਪੈਸੇ ਦਿੰਦੀ ਹੈ ਅਤੇ ਪੈਸੇ ਦਿੰਦੀ ਹੈ ਤਾਂ ਜੋ ਕਿ ਉਹ ਆਪਣਾ ਕੰਮ ਜਾਂ ਬਿਜਨਸ ਅੱਗੇ ਵਧਾ ਸਕਣ ਅਤੇ ਤਾਂ ਜੋ ਕਿ ਆਪਣੀ ਤਰੱਕੀ ਕਰ ਸਕਣ ਤਾਂ ਜੋ ਜਿਵੇਂ ਕਿ ਦੇਖਿਆ ਜਾਵੇ ਅੱਜ ਕੱਲ੍ਹ ਦੇ ਮਾਂ ਬਾਪ ਆਪ ਦੇ ਜਵਾਕ ਜਵਾਕਾਂ ਨੂੰ ਨਹੀਂ ਪੜ੍ਹਾ ਸਕਦੇ ਜਿਵੇਂ ਕਿ ਉਹ ਜਵਾਕ ਪੜ੍ਹਨਾ ਚਾਹੁੰਦਾ ਹੈ ਅਤੇ ਸਰਕਾਰ ਉਹਨਾਂ ਦੀ ਮਦਦ ਕਰਦੀ ਹੈ ਜਿ ਮਦਦ ਕਰਦੀ ਹੈ ਅਤੇ ਉਹਨਾਂ ਨੂੰ ਪੈਸੇ ਦਿੰਦੀ ਹੈ ਤਾਂ ਜੋ ਕਿ ਉਹ ਪੜ੍ਹ ਪੜ੍ਹਾਈ ਕਰ ਸਕਣ ਅਤੇ ਆਪਣਾ ਆਪਣੀ ਨੌਕਰੀ ਲੱਗ ਸਕਣ ਅਤੇ ਆਪਣੇ ਪਰਿਵਾਰ ਨੂੰ ਪਰਿਵਾਰ ਲਈ ਵਧੀਆ ਬਣ ਸਕੇ ਜਿਵੇਂ ਕਿ ਦੇਖਿਆ ਜਾਵੇ ਵਾਤਾਵਰਣ ਵਾਤਾਵਰਣ ਵਿੱਚ ਬਹੁਤ ਹੀ ਵਾਤਾਵਰਣ ਬਹੁਤ ਹੀ ਸਾਫ਼ ਸੁਥਰਾ ਹੋਣਾ ਚਾਹੀਦਾ ਸਰਕਾਰ ਦੁਆਰਾ ਕਿਹਾ ਗਿਆ ਹੈ ਜਿਵੇਂ ਕਿ ਕਿਹਾ ਗਿਆ ਹੈ ਕਿ ਅੱਜ ਕੱਲ੍ਹ ਵਿੱਚ ਬਹੁਤ ਹੀ ਵਾਤਾਵਰਣ ਵਿੱਚ ਬਹੁਤ ਹੀ ਸਮੱਸਿਆ ਆ ਚੁੱਕੀਆ ਹਨ ਵਾਤਾਵਰਣ ਬਹੁਤ ਹੀ ਭੈੜਾ ਲੱਗ ਰਿਹਾ ਆਪਣਾ ਆਲਾ ਦੁਆਲਾ ਸਰਕਾਰ ਦੁਆਰਾ ਕਿਹਾ ਗਿਆ ਹੈ ਕਿ ਆਪਣਾ ਆਲਾ ਦੁਆਲਾ ਸਾਫ਼ ਰੱਖੋ ਅਤੇ ਸਾਫ਼ ਰੱਖੋ ਅਤੇ ਤਾਂ ਕਿ ਜੋ ਕਿ ਗੰਦਗੀ ਨਾ ਫੈਲੀ ਹੋਵੇ ਅਤੇ ਰਾਜਨੀਤਿਕ ਸਮੱਸਿਆ ਦਾ ਹੱਲ ਕੀਤਾ ਜਾ ਸਕੇ ਅਤੇ ਪੰਜਾਬ ਸਰਕਾਰ ਦੁਆਰਾ ਕਿਹਾ ਗਿਆ ਹੈ ਕਿ ਪੰਜਾਬ ਨੂੰ ਦਰਵੇਸ਼ ਮੁੱਦਿਆਂ ਨੂੰ ਅਤੇ ਮੁੱਖ ਮੰਤਰੀ ਦੁਆਰਾ ਲਾਗੂ ਕੀਤੀ ਗਈ ਹੈ ਜੋ ਕਿ ਸਰਕਾਰੀ ਨੀਤੀਆਂ ਹੁੰਦੀਆਂ ਹਨ